ਪੰਜਾਬ ਵਿੱਚ ਹਰ ਦਿਨ ਬਹੁਤ ਸੈਲਾਨੀਆਂ ਆਉਂਦੇ ਹਨ ਅਤੇ ਸਭ ਤੋਂ ਪਹਿਲਾਂ ਇਹ ਗੋਲਡਨ ਟੈਂਪਲ ਜਾਂਦੇ ਹਨ ਜਿੱਥੇ ਹਰ ਦਿਸ਼ਾ ਵਿੱਚ ਇੱਕ ਦਰਵਾਜ਼ਾ ਲੱਗਿਆ ਹੋਇਆ ਹੈ ਲੋਕ ਗੋਲਡਨ ਟੈਂਪਲ ਵਿੱਚ ਆ ਕੇ ਇੱਕ ਚੱਕਰ ਲਗਾਉਂਦੇ ਹਨ ਅਤੇ ਆਪਣਾ ਮੱਥਾ ਟੇਕਦੇ ਹਨ ਗੋਲਡਨ ਟੈਂਪਲ ਵਿੱਚ ਇੱਕ ਨਦੀ ਵੀ ਹੈ ਜਿਸ ਵਿੱਚ ਲੋਕ ਮੱਛੀਆਂ ਨੂੰ ਵੇਖਦੇ ਹਨ ਉਸ ਤੋਂ ਬਾਅਦ ਲੋਕ ਇੱਥੇ ਭੋਜਨ ਕਰਦੇ ਹਨ ਦਰੀਆਂ 'ਤੇ ਬੈਠ ਕੇ ਭੋਜਨ ਕਰਦੇ ਹਨ ਅਤੇ ਮੱਥਾ ਟੇਕ ਕੇ ਫਿਰ ਉਹ ਆਪਣੀ ਨਵੀਆਂ ਨਵੀਆਂ ਜਗ੍ਹਾਵਾਂ 'ਤੇ ਘੁੰਮਣ ਲਈ ਨਿਕਲ ਜਾਂਦੇ ਹਨ ਜ਼ਿਆਦਾਤਰ ਲੋਕ ਉੱਥੇ ਵਾਹਗਾ ਬੋਡਰ ਵਿੱਚ ਜਾਂਦੇ ਹਨ ਜਿੱਥੇ ਬੀ ਐੱਸ ਐੱਫ ਨੂੰ ਦਿਖਾਇਆ ਜਾਂਦਾ ਹੈ ਬੀ ਐੱਸ ਐੱਫ ਪੰਜਾਬ ਲਈ ਕਿੰਨੀ ਜ਼ਰੂਰੀ ਹੈ ਉਹਨਾਂ ਦੀ ਯਾਦ ਵਿੱਚ ਉੱਥੇ ਇੱਕ ਮਿਊਜੀਅਮ ਵੀ ਬਣਿਆ ਹੋਇਆ ਹੈ ਜਿੱਥੇ ਉਹਨਾਂ ਦੀ ਹਿਸਟਰੀ ਦਿਖਾਈ ਜਾਂਦੀ ਹੈ ਅਤੇ ਉੱਥੇ ਇੱਕ ਐਰੋਪਲੇਨ ਦਾ ਢਾਂਚਾ ਵੀ ਰੱਖਿਆ ਹੋਇਆ ਹੈ ਜ਼ਿਆਦਾ ਲੋਕ ਉਸ ਤੋਂ ਬਾਅਦ ਕੰਪਨੀ ਬਾਗ ਜਾਂਦੇ ਹਨ ਜਿੱਥੇ ਬਹੁਤ ਹੀ ਝੂਲੇ ਲੱਗੇ ਹੋਏ ਹਨ ਉੱਥੇ ਬੋਟਿੰਗ ਕਰਦੇ ਹਨ ਖੇਡਦੇ ਹਨ ਮਜ਼ਾ ਕਰਦੇ ਹਨ ਅਤੇ ਬਹੁਤ ਤਰ੍ਹਾਂ ਦੇ ਝੂਲਿਆਂ ਵਿੱਚ ਆਪਣੇ ਆਪ ਨੂੰ ਵਿਅਸਤ ਰੱਖਦੇ ਹਨ ਜ਼ਿਆਦਾਤਰ ਲੋਕ ਇਸ ਤੋਂ ਬਾਅਦ ਜਲ੍ਹਿਆਂ ਵਾਲੇ ਬਾਗ ਹੀ ਜਾਂਦੇ ਹਨ ਜਿੱਥੇ ਪੰਜਾਬ ਦਾ ਇਤਿਹਾਸ ਦੱਸਿਆ ਗਿਆ ਹੈ ਪੰਜਾਬ ਦੇ ਕੇ ਅੰਗਰੇਜ਼ਾਂ ਨੇ ਪੰਜਾਬ ਵਿੱਚ ਗੋਲੀਆਂ ਚਲਾਈਆਂ ਸਨ ਅਤੇ ਉੱਥੇ ਗੋਲੀਆਂ ਵੀ ਰ ਬਣਾਈਆਂ ਗਈਆਂ ਹਨ ਦੀਵਾਰ ਟੁੱਟੀਆਂ ਛੱਡੀਆਂ ਗਈਆਂ ਹਨ ਅਤੇ ਲੋਕਾਂ ਦੀਆਂ ਢਾਂਚੇ ਬਣਾਏ ਗਏ ਹਨ ਅਤੇ ਬਹੁਤ ਹੀ ਸੋਹਣਾ ਤਾਂ ਦਿਖਾਇਆ ਗਿਆ ਹੈ ਇਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਲੋਕ ਸਾਡਾ ਪਿੰਡ ਜਾਂਦੇ ਹਨ ਜਿੱਥੇ ਪੰਜਾਬ ਦਾ ਕਲਚਰ ਦੱਸਿਆ ਜਾਂਦਾ ਹੈ ਪੰਜਾਬ ਦੇ ਬਾਰੇ ਦੱਸਿਆ ਜਾਂਦਾ ਹੈ ਪੰਜਾਬ ਦੇ ਪੁਰਾਣੇ ਘਰ ਦੱਸੇ ਜਾਂਦੇ ਹਨ ਪੰਜਾ ਪੰਜਾਬ ਦੀ ਪੁਰਾਣੀ ਤਕਨੀਕਾਂ ਦੱਸੀ ਜਾਂਦੀਆਂ ਪੰਜਾ ਪੰਜਾਬ ਦਾ ਪੁਰਾਣਾ ਘਰ ਦੱਸਿਆ ਜਾਂਦਾ ਹੈ ਕਿਵੇਂ ਪੰਜਾਬ ਵਿੱਚ ਖਾਣਾ ਬਣਦਾ ਹੈਗਾ ਸਭ ਕੁਛ ਦੱਸਿਆ ਗਿਆ ਹੈ ਉੱਥੇ ਬਹੁਤ ਸਾਰੇ ਪੁਤਲੇ ਹਨ ਅਤੇ ਬਹੁਤ ਹੀ ਵਧੀਆ ਤਰ੍ਹਾਂ ਦਾ ਹੈ